ਸਾਨੂੰ ਹਾਂਜੀ ਬਿਲਕੁਲ ਲੱਗਦਾ ਹੈ ਕਿ ਲੋਕਾਂ ਨੇ ਲੋਕਡਾਊਨ ਵਿੱਚ ਮੋਬਾਇਲ ਲੈਪਟੋਪ ਜਾਂ ਟੈਬਲੇਟਸ ਦੀ ਜ਼ਿਆਦਾ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਪਹਿਲਾਂ ਵੀ ਵਰਤੋਂ ਕਰਦੇ ਸਨ ਲੋਕ ਪਰ ਔਨਲਾਈਨ ਜਦੋਂ ਵੀ ਕੰਮ ਹੋਇਆ ਹੈ ਲੋਕਡਾਊਨ ਦਾ ਉਸ ਤੋਂ ਬਾਅਦ ਹੀ ਲੋਕਾਂ ਨੇ ਜ਼ਿਆਦਾਤਰ ਕੰਮ ਮੋਬਾਇਲ ਲੈਪਟੋਪ ਟੈਬਲੇਟਸ ਦੀ ਮਦਦ ਨਾਲ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਵੇਂ ਕਿ ਮੈਂ ਖੁਦ ਦੀ ਗੱਲ ਦੱਸਦਾ ਹਾਂ ਮੈਂ ਉਦੋਂ ਗ੍ਰੈਜੁਏਸ਼ਨ ਕਰ ਰਿਹਾ ਸੀ ਅਤੇ ਮੈਂ ਇੱਕ ਸਾਲ ਲਗਾਇਆ ਅਤੇ ਉਸ ਤੋਂ ਬਾਅਦ ਲੋਕਡਾਊਨ ਲੱਗ ਗਿਆ ਅਤੇ ਬਾਅਦ ਵਾਲੇ ਮੈਂ ਦੋ ਸਾਲ ਲੋਕਡਾਊਨ ਵਿੱਚ ਹੀ ਬਿਤਾਏ ਇਸ ਵਿੱਚ ਮੇਰਾ ਤਜ਼ਰਬਾ ਤਾਂ ਮੈਂ ਆਪਣੇ ਅਕੋਡਿੰਗ ਮੇਰੇ ਅਨੁਸਾਰ ਇਹੀ ਦੱਸਾਂਗਾ ਕਿ ਬਹੁਤ ਵਧੀਆ ਰਿਹਾ ਕਿਉਂਕਿ ਉੱਥੇ ਸਾਨੂੰ ਥੋੜ੍ਹੀਆਂ ਬਹੁਤੀਆਂ ਸਬਮਿਟ ਅਸਾਈਨਮੈਂਟਾਂ ਸਬਮਿਟ ਕਰਨੀਆਂ ਪੈਂਦੀਆਂ ਸੀ ਜੋ ਕਿ ਹੱਥਾਂ ਨਾਲ ਬਹੁਤ ਜ਼ਿਆਦਾ ਲਿਖਣਾ ਪੈਂਦਾ ਸੀ ਅਤੇ ਅਟੈਡੈਂਸ ਦਾ ਵੀ ਚੱਕਰ ਪੈਂਦਾ ਸੀ ਇਸ ਕਰਕੇ ਔਨਲਾਈਨ ਸਾਡਾ ਤਜ਼ਰਬਾ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਹੈ